ਹੈਲੋ ਹਾਂਜੀ ਹੈਲੋ ਹਾਂਜੀ ਉਹ ਮੈਂ ਆਪਣਾ ਬੱਚਾ ਲਾਉਣਾ ਤਾ ਜੀ ਸਕੂਲ ਦੇ ਵਿੱਚ ਇੱਥੇ ਹੈਲੋ ਸਕੂਲ ਦੱਸੋ ਮਾੜਾ ਜਾ ਵੀ ਕਿ ਵਧੀਆ ਕਿਵੇਂ ਸਕੂਲ ਹਾਂ ਹਾਂਜੀ ਮੈਂ ਲਖਬੀਰ ਸਿੰਘ ਬੋਲਦਾ ਜੀ ਹਾਂ ਹਾਂਜੀ ਹਾਂਜੀ ਬੱਚਾ ਦਸਵੀਂ ਕਲਾਸ 'ਚ ਲਾਉਣਾ ਆਪਾਂ ਨੇ

ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਵਧੀਆ ਸਕੂਲ ਦੱਸੋ ਕੋਈ ਇਹਦੇ 'ਚ ਕਿਵੇਂ ਹੈ ਫੀਸਾਂ ਫੂਸਾਂ ਦਾ ਕੀ ਹਿਸਾਬ ਕਿਤਾਬ ਆ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਕਿੰਨੀ ਕੁ ਫੀਸ ਹੈ ਫਿਰ ਵੀ ਕਿੰਨੀ ਕੁ ਫੀਸ ਹੋ ਜਾਂਦੀ ਹੈ ਐਡਮਿਸ਼ਨ ਫੀਸ

ਅੱਛਾ ਜੀ ਬੱਸ ਹਾਂ

ਅੱਛਿਆ ਜੀ ਅੱਛਾ ਜੀ ਅਤੇ ਖੇਡਾਂ ਖੂਡਾਂ ਖੇਡਣ ਨੂੰ ਵੀ ਹੈਂਗੇ ਐਂ ਜੀ ਹੈਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਅਤੇ ਪ੍ਰਿੰਸੀਪਲ ਦਾ ਕੀ ਨਾਮ ਆ ਜੀ ਆਪਣਾ ਮਨਜੀਤ ਸਿੰਘ ਅੱਛਿਆ ਜੀ ਠੀਕ ਹੈ ਟੀਚਰ ਕਿੰਨੇ ਕੁ ਆ ਇੱਥੇ ਅੱਛਾ ਠੀਕ ਹੈ ਜੀ ਅੱਛਿਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਦਸਵੀਂ ਕਲਾਸ 'ਚ ਲਗਾਉਣਾ ਜੀ ਅੱਛਾ ਜੀ ਅੱਛਾ ਜੀ ਅਤੇ ਫਿਰ ਦੇਖੋ ਜੀ ਫਿਰ ਧਿਆਨ ਰੱਖਿਓ ਆਪਾਂ ਨੇ ਬੱਚਾ ਲਾਉਣਾ ਜੀ ਅਤੇ ਫਿਰ ਕਦੋਂ ਆਈਏ ਫਿਰ ਤੁਹਾਡੇ ਕੋਲ ਹਾਂਜੀ ਅਤੇ ਨਤੀਜਾ ਕਿਵੇਂ ਆ ਨਤੀਜਾ ਕਿਵੇਂ ਬੱਚੇ ਪ ਪੜ੍ਹਾਈ ਪੜੁਈ 'ਚ ਕਿਵੇਂ ਹਾਂ ਫਸਟ ਸੈਕਿੰਡ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਆਊਂਗਾ ਜੀ ਫਿਰ ਮੈਂ ਚੰਗਾ